ਸਾਡੀ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਮੁਹਾਵਰੇ ਹਨ ਜਿਨ੍ਹਾਂ ਵਿੱਚੋਂ ਕੁਛ ਇਹ ਹਨ ਹਨੇਰੇ ਮਾਈ ਦਾ ਹਵਾ ਨੂੰ ਸੋਟੇ ਮਾਰਨਾ ਹਿੱਕ ਕੱਢ ਕੇ ਤੁਰਨਾ ਹਿੱਕ ਤੇ ਮੂੰਗੇ ਡਾਲਨਾ ਹੋਏ ਹੋਏ ਹੋਣੀ ਹੱਥ ਹੱਥ ਪੈ ਜਾਣਾ ਹਰ ਮਸਲੇ ਪੱਪਲਾ ਮੁੱਲ ਸਿਰ ਮਨਾਉਣਾ ਸਿਰ ਆਉਣਾ ਸੋਟਾ ਪੈ ਜਾਣਾ ਅੰਮੀ ਜੰਮੀ ਆਲੇ ਕੋਲੇ ਮੂੰਹ ਮਾਰਨਾ ਆਟਾ ਖਰਾਬ ਕਰਨਾ ਉੱਲੀ ਮਿਲ ਚੱਟਨੀ ਅੱਗੇ ਹਿੱਕਨਾ ਅੱਖਾਂ ਵਟਾਉਂਣੀਆਂ ਅੱਖਾਂ ਚੁੰਡੀਆਂ ਜਾਣੀਆਂ ਅੱਖਾਂ ਵਿੱਚ ਚੱਟਣਾ ਅੱਖਾਂ ਵਿੱਚ ਛਾਨਾ ਅਗੇਰੇ ਕਰਨੀ ਇਹਨਾਂ ਤੋਂ ਇਲਾਵਾ ਸਾਡੇ ਪੰਜਾਬੀ ਭਾਸ਼ਾ ਵਿੱਚ ਹੋਰ ਵੀ ਮੁਹਾਵਰੇ ਹਨ